ਅਸੀਂ ਕੁਦਰਤ ਨੂੰ ਬਹੁਤ ਤਰੀਕਿਆਂ ਨਾਲ ਬਚਾ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਰੁੱਖ ਲਗਾ ਕੇ ਹਵਾ ਨੂੰ ਸ਼ੁੱਧ ਕਰ ਸਕਦੇ ਹਾਂ ਜੇਕਰ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਤਾਂ ਸਾਡੇ ਵਾਤਾਵਰਨ ਨੂੰ ਵਾਤਾਵਰਨ ਸ਼ੁੱਧ ਹੋਵੇਗਾ ਅਤੇ ਉਹ ਸਾਫ ਵੀ ਰਹੇਗਾ ਅਸੀਂ ਪਾਣੀ ਨੂੰ ਗੰਦਾ ਹੋਣ ਤੋਂ ਬਚਾ ਕੇ ਵੀ ਇਸਨੂੰ ਕੁਦਰਤ ਨੂੰ ਸਾਫ਼ ਰੱਖ ਸਕਦੇ ਹਾਂ ਅਤੇ ਮਿੱਟੀ ਤੋਂ ਮਿੱਟੀ ਨੂੰ ਵੀ ਜੋ ਅੱਜ ਕੱਲ੍ਹ ਮਿੱਟੀ ਪਰ ਜ਼ਹਿਰ ਛਿੜਕਿਆ ਜਾ ਕੈਮੀਕਲ ਛਿੜਕੇ ਜਾ ਰਹੇ ਹਨ ਉਸ ਤੋਂ ਬਚਾ ਕੇ ਵੀ ਅਸੀਂ ਕੁਦਰਤ ਨੂੰ ਬਚਾ ਸਕਦੇ ਹਾਂ